ਮੈਂ ਮੁਕਤਸਰ ਦੀ ਰਹਿਣ ਵਾਲੀ ਹਾਂ ਜਿਵੇਂ ਕਿ ਸਾਡੇ ਮੁਕਤਸਰ ਵਿੱਚ ਵੀ ਰੈਡ ਕ੍ਰੋਸ ਭਵਨ ਹੈ ਉੱਥੇ ਬੱਚਿਆਂ ਨੂੰ ਸਿਲਾਈ ਕਢਾਈ ਪੇਂਟਿੰਗ ਵੀ ਮਤਲਬ ਸਿਖਾਈਆਂ ਜਾਂਦੀਆਂ ਮਹਿੰਦੀ ਵਗੈਰਾ ਲਾਉਣਾ ਸਿਖਾਈਆਂ ਜਾਂਦੀਆ ਹੈ ਹੋਰ ਵੀ ਕਈ ਤਰ੍ਹਾਂ ਦੀਆਂ ਸੰਸਥਾਵਾਂ ਹਨ ਜਿੱਥੇ ਕਿ ਜਿਵੇਂ ਕਿ ਕ੍ਰੇਟੀਵ ਆਰਟਸ ਇੰਸਟੀਚਿਊਟ ਲੁਧਿਆਣਾ ਮੂਰਤੀ ਕਲਾ ਇਹ ਮੂਰਤੀਆਂ ਬਣਾਈਆਂ ਜਾਂਦੀਆਂ ਹਨ ਉੱਥੇ ਸਿਖਾਈਆਂ ਜਾਂਦੀਆਂ ਹਨ ਬੱਚਿਆਂ ਨੂੰ ਪੰਜਾਬ ਕਲਾ ਭਵਨ ਚੰਡੀਗੜ੍ਹ ਚ ਵੀ ਇਹ ਕਲਾ ਬੱਚਿਆਂ ਨੂੰ ਸਿਖਾਈਆ ਜਾਂਦੀਆਂ ਹਨ ਸਰਕਾਰੀ ਕਾਲਜ ਆਫ ਆਰਟਸ ਚੰਡੀਗੜ੍ਹ ਇੱਥੇ ਬੱਚਿਆਂ ਨੂੰ ਕੀਰਤਨ ਵਗੈਰਾ ਵੀ ਸਿਖਾਇਆ ਜਾਂਦਾ ਹੈ ਪੰਜਾਬ ਨਾਟਸ਼ਾਲਾ ਅੰਮ੍ਰਿਤਸਰ ਇਹ ਨਾਟਕ ਵਗੈਰਾ ਬੱਚਿਆਂ ਨੂੰ ਸਿਖਾਏ ਜਾਂਦੇ ਹਨ ਖਾਲਸਾ ਕਾਲਜ ਅੰਮ੍ਰਿਤਸਰ ਇਹ ਭੰਗੜਾ ਗਿੱਧਾ ਇਹ ਵੀ ਬੱਚਿਆਂ ਨੂੰ ਉੱਥੇ ਸਿਖਾਇਆ ਜਾਂਦਾ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਵੀ ਇਹ ਚੀਜ਼ਾਂ ਸਾਰੀਆਂ ਸਿਖਾਈਆਂ ਜਾਂਦੀਆਂ ਹਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਡ ਯੂਨੀਵਰਸਿਟੀ ਪਟਿਆਲਾ ਇਹਦੇ ਵਿੱਚ ਵੀ ਸ਼ੁੱਧ ਗੁਰਬਾਣੀ ਕਥਾ ਕੀਰਤਨ ਸਭ ਕੁਝ ਸਿਖਾਇਆ ਜਾਂਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਇਹਦੇ ਵਿੱਚ ਵੀ ਕਥਾ ਕੀਰਤਨ ਅਤੇ ਹਾਰਮੋਨੀਅਮ ਤਬਲਾ ਵਗੈਰਾ ਢੱਡ ਸਾਰੰਗੀ ਇਹ ਸਭ ਜੋ ਵੀ ਮਤਲਬ ਸਾਜ ਹਨ ਉਹ ਬੱਚਿਆਂ ਨੂੰ ਬੜੀ ਵਧੀਆ ਤਰੀਕੇ ਨਾਲ ਸਿਖਾਇਆ ਜਾਂਦਾ ਹੈ ਅਤੇ ਹੋਰ ਅਤੇ ਘਰਾਂ ਵਿੱਚ ਵੀ ਲੋਕ ਲੋਕਾਂ ਗਾਹ ਸਿੱਖ ਕੇ ਅੱਗੋਂ ਜੋ ਵੀ ਆਪਣੇ ਨਿੱਜੀ ਕੰਮ ਕਰਦੇ ਹਨ ਉਹ ਵੀ ਇਹ ਅੱਗੇ ਤੇ ਅੱਗੇ ਬੱਚਿਆਂ ਨੂੰ ਸਿਖਾਉਂਦੇ ਹਨ ਅਤੇ ਜਾਂ ਹਰ ਥਾਂ ਅਸੀਂ ਤਾਂ ਕਹਿੰਦੇ ਵੀ ਹਰ ਥਾਂ ਹਰ ਜ਼ਿਲ੍ਹੇ ਦੇ ਵਿੱਚ ਇਹੋ ਜਿਹੀਆਂ ਸੰਸਥਾਵਾਂ ਕੰਮ ਕਰਨਾ ਚਾਹੁੰਦੀਆਂ ਨੇ ਕਿਉਂਕਿ ਜੋ ਬੱਚ ਜੋ ਦੂਰੋਂ ਦੂਰੋਂ ਬੱਚੇ ਪੜ੍ਹਨਾ ਕਰਨਾ ਚਾਹੁੰਦੇ ਹਨ ਉਹ ਤੁਹਾਨੂੰ ਇਹ ਸਿਖਲਾਈ ਮਿਲੇ ਅਤੇ ਤਾਂ ਕਿ ਉਹ ਆਪਣਾ ਰੁਜ਼ਗਾਰ ਜਿਹੜਾ ਉਹ ਵੀ ਆਪਣਾ ਚੰਗੀ ਤਰ੍ਹਾਂ ਸਿਖਾ ਸ ਚਲਾ ਸਕਣ ਅਤੇ ਉਹਨਾਂ ਦੀ ਰੋਜ਼ੀ ਰੋਟੀ ਬਣੀ ਰਹੇ ਹੋਰ ਸੰਸਥਾਵਾਂ ਸਾਨੂੰ ਵੀ ਚਾਹੀਦਾ ਵੀ ਅਸੀਂ ਵੀ ਉਹਨਾਂ ਚ ਸਹਿਯੋਗ ਪਾਈਏ ਅਤੇ ਕੰਮ ਕਰੀਏ ਸੰਸਥਾ ਦੇ ਨਾਲ ਰਲ ਕੇ ਸਾਨੂੰ ਵੀ ਖੁਸ਼ੀ ਹੋਏਗੀ ਅਤੇ ਜਾਂ ਬੱਚਿਆਂ ਨੂੰ ਸਿੱਖਣ ਵਾਲਿਆਂ ਨੂੰ ਵੀ ਖੁਸ਼ੀ ਹੋਵੇਗੀ ਉਹਨਾਂ ਦਾ ਭਵਿੱਖ ਜਿਹੜਾ ਉਹ ਵਧੀਆ ਬਣੇਗਾ ਠੀਕ